ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਕੱਲ੍ਹ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਪੰਜਾਬੀ ਗਾਣੇ ਬਹੁਤ ਪਸੰਦ ਹਨ ਪੰਜਾਬੀ ਗੀਤ ਬਹੁਤ ਪਸੰਦ ਹਨ ਅਤੇ ਮੈਨੂੰ ਵੀ ਪੰਜਾਬੀ ਗੀਤ ਬਹੁਤ ਪਸੰਦ ਹੈ ਮੈਂ ਜਦੋਂ ਗੀਤ ਕੋਈ ਪੇਸ਼ ਕਰਦੀ ਹਾਂ ਜਾਂ ਫਿਰ ਰਿਕਾਰਡ ਕਰਦੀ ਹਾਂ ਉਹਨੂੰ ਮੈਂ ਬਹੁਤ ਸੋਚ ਸਮਝ ਕੇ ਚੋਣ ਕਰਦੀ ਹਾਂ ਉਹਦੀ ਜਿਵੇਂ ਪਹਿਲਾਂ ਮੈਂ ਦੇਖਦੀ ਹਾਂ ਕਿ ਉਹ ਇੱਦਾਂ ਦੀ ਲਾਈਨ ਆ ਹੁਣ ਇੱਦਾਂ ਦੀ ਲਾਈਨਾਂ ਮੈਂ ਉਹ ਪੇਸ਼ ਕਰਦੀ ਹਾਂ ਜਿਹਦੇ ਵਿੱਚ ਸਾਰੇ ਹੀ ਅਰਥ ਸਮਝ ਆਣ ਅਤੇ ਔਖੀ ਵਰਡਿੰਗ ਨਾ ਹੋਵੇ ਅਤੇ ਦੂਜਾ ਮੈਂ ਦੇਖਦੀ ਹਾਂ ਕਿ ਉਹਦੇ ਨਾਲ ਵਧੀਆ ਸਮਾਜ ਨੂੰ ਮੈਸੇਜ ਮਿਲੇ ਅਤੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਦਰਸ਼ਾਇਆ ਜਾਵੇ ਜਿਵੇਂ ਕਿ ਹੋ ਗਿਆ ਸੰਸਾਰਿਕ ਮਾਹੌਲ ਬਾਰੇ ਦੱਸਿਆ ਜਾਵੇ ਜਾਂ ਫਿਰ ਕੋਈ ਆਸ ਪਾਸ ਦੇ ਮਾਹੌਲ ਬਾਰੇ ਦੱਸਿਆ ਜਾਵੇ ਜਾਂ ਫਿਰ ਕੁਦਰਤ ਬਾਰੇ ਦੱਸਿਆ ਜਾਵੇ ਅਤੇ ਮੇਰੀ ਚੋਣ ਕਰਨ ਦੀ ਪਸੰਦ ਬਹੁਤ ਵੱਖਰੀ ਹੈ ਮੈਨੂੰ ਖਾਸ ਤੌਰ 'ਤੇ ਪੁਰਾਣੇ ਜਮਾਨੇ ਦੇ ਪੁਰਾਣੇ ਜ਼ਮਾਨੇ ਦੇ ਗੀਤ ਜ਼ਿਆਦਾ ਪਸੰਦ ਆਉਂਦੇ ਹਨ ਜਿਵੇਂ ਕਿ ਲਤਾ ਮੰਗੇਸ਼ਰ ਦੇ ਗੀਤ ਮੈਨੂੰ ਬਹੁਤ ਜ਼ਿਆਦਾ ਪਸੰਦ ਹਨ ਮੈਂ ਮੈਂ ਇਹ ਨਹੀਂ ਕਹਿੰਦੀ ਕਿ ਮੈਨੂੰ ਪੁਰਾਣੇ ਨਵੇਂ ਹੁਣ ਅਤੇ ਜ਼ਮਾਨੇ ਦੀ ਗੀਤ ਨਹੀਂ ਪਸੰਦ ਆ ਮੈਨੂੰ ਪਸੰਦ ਆ ਬਟ ਕਈ ਲੋਕਾਂ ਦੇ ਜਿਵੇਂ ਕਿ ਹੋ ਗਿਆ ਬੱਬੂ ਮਾਨ ਦੇ ਮੈਨੂੰ ਗੀਤ ਪਸੰਦ ਹਨ ਅਤੇ ਮਤਲਬ ਹੋਰ ਵੀ ਬਹੁਤ ਗਾਇਕ ਨੇ ਜਿਹਨਾਂ ਦੇ ਗੀਤ ਬਹੁਤ ਵਧੀਆ ਹੁੰਦੇ ਹਨ ਪਰ ਹਾਂ ਜਦੋਂ ਮੈਂ ਉਹਨੂੰ ਉਹਨਾਂ ਨੂੰ ਪੇਸ਼ ਕਰਨਾ ਚਾਹੂੰਗੀ ਅਤੇ ਰਿਕਾਰਡ ਕਰਨਾ ਚਾਹੂੰਗੀ ਅਤੇ ਮੈਂ ਆਪਣੇ ਗੀਤ ਜਿਹੜੇ ਹੈਗੇ ਆ ਉਹ ਪੁਰਾਣੇ ਜ਼ਮਾਨੇ ਵਾਲੇ ਗੀਤ ਹੀ ਪਰਾ ਪਸੰਦ ਕਰ ਲਉਂਗੀ ਕਿ ਮੈਂ ਉਹ ਪੇਸ਼ ਕਰਾਂ ਅਤੇ ਉਹਨਾਂ ਨੂੰ ਰਿਕਾਰਡ ਕਰਾਂ ਅਤੇ ਇੱਦਾਂ ਦੀਆਂ ਲਾਈਨਾਂ ਦੀ ਚੋਣ ਕਰਾਂ ਜਿਹਨਾਂ ਵਿੱਚ ਅਰਥ ਹੋਵੇ ਅਤੇ ਸਮਾਜ ਨੂੰ ਅਸੀਂ ਵਿਦਿਆਰਥੀਆਂ ਨੂੰ ਅਤੇ ਲੋਕਾਂ ਨੂੰ ਵਧੀਆ ਮੈਸੇਜ ਜਾਵੇ